ਆਰਟਸ ਫੁਲਕਾਰੀ ਫੈਬਰਿਕ ਅਤੇ ਗੁੰਝਲਦਾਰ ਕਢਾਈ ਅਕਸਰ ਫੁੱਲਾਂ ਦੇ ਨਮੂਨੇ ਨੂੰ ਦਰਸਾਉਂਦੀ ਹੈ ਪੰਜਾਬੀ ਕਠਪੁਤਲੀ ਲੱਕੜ ਜਾਂ ਕੱਪੜੇ ਤੋਂ ਬਣਿਆ ਰੰਗੀਨ ਕਠਪੁਤਲਿਆਂ ਕਾਣੇ ਸੁਣਾਵਾ ਲਈ ਵਰਤੀਆਂ ਜਾਂਦੀਆਂ ਹਨ ਫਰਮਾਰਿੰਕ ਆਰਟਸ ਭੰਗੜਾ ਗਿੱਧਾ ਝੂੰਮਰ ਮਾਲਵਾ ਖੇਤਰ ਦਾ ਲੋਕ ਨਾਚ ਜੋ ਆਪਣੀ ਤਾਲ ਦੀ ਊਰਜਾ ਲਈ ਜਾਣਿਆ ਜਾਂਦਾ ਹੈ ਸੰਗੀਤ ਲੋਕ ਗੀਤ ਪ੍ਰੰਪਰਾਗਤ ਗੀਤ ਅਕਸਰ ਪਿਆਰ ਹਿੰਮਤ ਅਤੇ ਰੋਜ਼ਾਨਾ ਜੀਵਨ ਜੀਵਨ ਦੀਆਂ ਕਹਾਣੀਆਂ ਨੂੰ ਬਿਆਨ ਕਰਦੇ ਹਨ ਕਵਾਲੀ ਭਗਤੀ ਸੰਗੀਤ ਸੂਫੀ ਸਤਾ ਦੁਆਰਾ ਪ੍ਰਸਿੱਧ ਹਨ ਅਲਗੋਜ ਪ੍ਰੰਪਰਾ ਬਰ ਬਸਰੀ ਅਧਾਰਿਤ ਸੰਗੀਤ ਕਹਾਣੀ ਨਾਲ ਜੁੜੀ ਪਰੰਪਰਾਗਤ ਕਲਾ ਵਾਰਲੀ ਪੇਂਟਿੰਗ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪੈਦਾ ਹੋਈ ਵਾਰਲੀ ਪੇਂਟਿੰਗ ਰੋਜ਼ਾਨਾ ਜੀਵਨ ਦੇ ਅਤੇ ਪਰਿਵਾਰ ਅਤੇ ਮਿਥਾਂ ਨੂੰ ਦਰਸ਼ਾਉਂਦੀ ਹੈ ਵਾਰਲੀ ਪੇਂਟਿੰਗ ਨਾਲ ਜੁੜੀ ਇੱਕ ਅਸੋਰ ਕਈ ਕਹਾਣੀ ਧਰਤੀ ਅਤੇ ਆਸਮਾਨ ਦੇ ਵਿਆਹ ਦੀ ਕਥਾ ਹੈ ਜੋ ਕੁਦਰਤ ਨਾਲ ਮਨੁੱਖਾਂ ਦੇ ਮਿਲ ਮਿਲਾਪ ਦਾ ਪ੍ਰਤੀਕ ਹੈ